ਹੈਲੋ

ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਅੱਛਾ ਜੀ ਆਪਣੇ ਬਸ ਦੋ ਡਰੈਸਾਂ ਲੱਗਦੀਆਂ ਹੈ ਜਿਵੇਂ ਕਿ ਚਿੱਟਾ ਕੁੜਤਾ ਪਜਾਮਾ ਹੋ ਗਿਆ ਅਤੇ ਇੱਕ ਤਾਂ ਮਤਲਬ ਸੰਤਰੀ ਕਲਰ 'ਚ ਜਿਵੇਂ ਪੱਗ ਆਉਂਦੀ ਹੈ ਇੱਕ ਨੀ ਨੀਲੇ 'ਚ ਅਤੇ ਹਾਂਜੀ ਆਈ ਡੀ ਪਰੂਫ ਆਪਣਾ ਬੱਚਾ ਕਿੰਨੇ ਸਾਲ ਦਾ ਓਕੇ ਮਤਲਬ ਪਹਿਲੀ ਵਾਰੀ ਅਡਮੀਸ਼ਨ ਕਰਾ ਰਹੇ ਹੋ ਜਾਂ ਪਹਿਲਾਂ ਵੀ ਕਿਸੇ ਸਕੂਲ ਵਿੱਚ ਹਾਂਜੀ ਓਕੇ ਕਿੰਨੇ ਸਾਲ ਦਾ ਬੱਚਾ ਆਪਣਾ ਬਸ ਉਹ ਤੁਹਾਡੇ ਪਰੂਫ ਲੱਗਣਗੇ ਮੰਮਾ ਦੇ ਅਤੇ ਬੱਚੇ ਦੀ ਫੋਟੋ ਲੱਗੇਗੀ ਪਾਸਪੋਰਟ ਫੋਟੋ ਤੁਹਾਡਾ ਜਿਵੇਂ ਪੈੱਨ ਕਾਡ ਅਧਾਰ ਕਾਡ ਵਗੈਰਾ ਤੁਸੀਂ ਬੱਚੇ ਦਾ ਸਰਟੀਫਿਕੇਟ ਲੱਗੇਗਾ ਅਤੇ ਬੱਚੇ ਦੀ ਪਾਸਵਰਡ ਫੋਟੋ ਹੈਗੀ ਹੈ ਤੁਹਾਡੇ ਕੋਲ ਓਰੀਜਨਲ ਹੈਗੇ ਹੈ ਬੱਚੇ ਦੇ ਸਰਟੀਫਿਕੇਟ ਠੀਕ ਹੈ ਜੀ ਤੁਸੀਂ ਚਲੋ ਕੱਲ੍ਹ ਆ ਸਕਦੇ ਹੋ ਮੋਰਨਿੰਗ ਟਾਈਮ ਸੁਬਾਹ ਹਾਂ ਹਾਂਜੀ ਅਤੇ ਮਤਲਬ ਤੁਸੀਂ ਮਦਰ ਬੋਲ ਰਹੇ ਹੋ ਤਾਂ ਤੁਹਾਨੂੰ ਫਿਰ ਨਾਲ ਹੀ ਆਉਣਾ ਪਵੇਗਾ ਬੱਚੇ ਦੇ ਕਿਉਂਕਿ ਤੁਹਾਡੇ ਸਿਗਨੇਚਰ ਵਗੈਰਾ ਹੋਣਗੇ ਹਾਂਜੀ ਅਤੇ ਤੁਹਾਡੇ ਪਰੂਫ ਵੀ ਬੱਚੇ ਦੇ ਨਾਲ ਲੱਗਣਗੇ ਤੁਹਾਡੀਆਂ ਪਾਸਵਰਡ ਫੋਟੋ ਬੱਚੇ ਦੀਆਂ ਪਾਸਵਰਡ ਫੋਟੋ ਓਕੇ ਸਤਿ ਸ਼੍ਰੀ ਅਕਾਲ